ਮੈਨੂੰ ਪਾਸਤਾ ਬੜਾ ਹੀ ਪਸੰਦ ਹੈ ਜੋ ਕਿ ਮੈਨੂੰ ਕੈਫੇ ਵਿਲਾ ਦਾ ਜ਼ਿਆਦਾ ਪਸੰਦ ਆਉਂਦਾ ਹੈ ਉਹ ਕੈਫੇ ਵਿਲਾ ਤਰਨਤਾਰਨ ਦੇ ਬਾਈਪਾਸ ਚ ਪੈਂਦਾ ਹੈ ਅਤੇ ਮੇਰਾ ਪਤਾ ਹੈਗਾ ਮੱਲਾ ਭਾਗ ਸ਼ਾਹ ਪਨੇਸਰ ਹਵੇਲੀ ਤਰਨਤਾਰਨ